ਹਾਂਜੀ ਸਾਨੂੰ ਪਾਣੀ ਦੀ ਸਪਲਾਈ ਜਿਹੜੀ ਹੈ ਉਹ ਮਿਲਦੀ ਹੈ ਜਿਹੜਾ ਟੂਟੀ ਵਾਲਾ ਪਾਣੀ ਹੈ ਉਹ ਨਲ਼ਕੇ ਵਾਲੇ ਪਾਣੀ ਨਾਲੋਂ ਕਿਤੇ ਸਾਫ ਹੁੰਦਾ ਹੈ ਕਿਉਂਕਿ ਜਿਹੜਾ ਟੂਟੀ ਵਾਲਾ ਪਾਣੀ ਹੈ ਉਹ ਚਾਰ ਸੌ ਪੰਜ ਸੌ ਫੁੱਟ ਜਿਹੜਾ ਉਹ ਨੀਵਾਂ ਹੁੰਦਾ ਹੈ ਜਿਸ ਕਰਕੇ ਉਹ ਪਾਣੀ ਬਿਲਕੁਲ ਸਾਫ ਹੁੰਦਾ ਹੈ ਜਿਹਦੇ ਵਿੱਚ ਕੋਈ ਵੀ ਕੀਟਾਣੂ ਨਹੀਂ ਹੁੰਦੇ ਪਰ ਜਿਹੜਾ ਨਲ਼ਕੇ ਵਾਲਾ ਪਾਣੀ ਹੈ ਉਹ ਇੱਕ ਦੋ ਘੰਟੇ ਬਾਅਦ ਹੀ ਜਿਹੜਾ ਉਹ ਪੀਲਾ ਹੋ ਜਾਂਦਾ ਹੈ ਇਸ ਕਰਕੇ ਜਿਹੜਾ ਸਪਲਾਈ ਵਾਲਾ ਪਾਣੀ ਹੈ ਟੂਟੀ ਵਾਲਾ ਪਾਣੀ ਹੈ ਉਹ ਸਾਡੀ ਸਿਹਤ ਲਈ ਜਿਹੜਾ ਜ਼ਿਆਦਾ ਫਾਇਦੇਮੰਦ ਹੈ